ਹਾਂਜੀ ਸਥਾਨਕ ਬਾਜ਼ਾਰ 'ਚ ਖੇਤੀਬਾੜੀ ਉਤਪਾਦਾਂ ਨੂੰ ਪਹੁੰਚਾਉਣ 'ਚ ਲੋਕਾਂ ਨੂੰ ਮੈਨੂੰ ਨਹੀਂ ਲੱਗਦਾ ਕੋਈ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਆਉਂਦਾ ਹੈ ਕਿਉਂਕਿ ਕਿਸਾਨ ਆਪਣੀ ਫ਼ਸਲ ਹੈ ਜਿਹੜੀ ਉਹ ਖੇਤ ਚੋਂ ਵੱਢ ਕੇ ਲਿਆ ਕੇ ਮੰਡੀ 'ਚ ਸੁੱਟਦਾ ਅਤੇ ਸਰਕਾਰ ਵੱਲੋਂ ਰੇਟ ਫਿਕਸ ਹੁੰਦਾ ਇਹ ਤਾਂ ਹੈ ਨਹੀਂ ਗਾ ਵੀ ਕੋਈ ਵੀ ਵਪਾਰੀ ਆਪਦੀ ਮਰਜ਼ੀ ਨਾਲ ਰੇਟ ਲਾ ਦੂਗਾ ਵੀ ਮੈਂ ਐਨੀ ਦੀ ਕਣਕ ਖਰੀਦਣੀ ਜਾਂ ਝੋਨਾ ਖਰੀਦਣਾ ਉਹ ਤਾਂ ਰੇਟ ਫਿਕਸ ਹੁੰਦਾ ਉਸ ਰੇਟ 'ਤੇ ਮਤਲਬ ਚੱਕੀ ਜਾਂਦੀ ਹੈਗੀ ਆ ਕਣਕ ਜਾਂ ਜੋ ਵੀ ਹੈ ਝੋਨਾ ਆੜਤੀਏ ਉੱਥੋਂ ਚੁੱਕਦੇ ਆ ਉਸ ਤੋਂ ਵੱਧ ਮੁੱਲ ਉਹ ਲੈ ਹੀ ਨਹੀਂ ਸਕਦੇ ਰੇਟ ਹਰੇਕ ਸਾਲ ਕੋਈ ਪੰਜਾਹ ਸੌ ਰੁਪਏ ਵੀ ਵਧਾ ਦਿੱਤਾ ਜਾਂਦਾ ਹੈਗਾ ਕਿਸਾਨ ਨੂੰ ਵੀ ਉਹਦੇ ਨਾਲ ਫ਼ਾਇਦਾ ਹੋ ਜਾਂਦਾ ਅਤੇ ਬੰਦਾ ਆਪਣੇ ਵਰਤਣ ਜੋਗੀ ਘਰੇ ਰੱਖ ਕੇ ਬਾਕੀ ਸਾਰੀ ਵੇਚ ਕੇ ਫ਼ਸਲ ਕਿਸਾਨ ਆਪਣਾ ਟਾਈਮ ਟਪਾਉਂਦਾ ਉਹਦੇ ਨਾਲ ਕਿਉਂਕਿ ਐਮ ਐਸ ਪੀ ਕਰਕੇ ਇੱਥੇ ਕੋਈ ਔਕੜਾਂ ਵਾਲਾ ਕੰਮ ਤਾਂ ਹੈ ਨਹੀਂ ਗਾ ਵੀ ਬਾਜ਼ਾਰ 'ਚ ਲੈ ਕੇ ਜਾਣੀ ਔਖੀ ਹੈਗੀ ਆ ਅਤੇ ਖੇਤੀਬਾੜੀ ਵਾਲਿਆਂ ਕੋਲ ਸਾਰਿਆਂ ਕੋਲ ਟਰੈਕਟਰ ਟਰਾਲੀਆਂ ਵੀ ਹੁੰਦੇ ਆ ਲੋਕ ਆਪਣੇ ਹੀ ਉਹਦੇ ਵਿੱਚ ਲੈ ਆਉਂਦੇ ਆ ਤੂੜੀ ਵਗੈਰਾ ਵੀ ਮੁੜ ਕੇ ਆਪਣੀ ਸਟੋਰ ਕਰਕੇ ਰੱਖ ਲੈਂਦੇ ਹੈਗੇ ਆ